ਹੈਲੋ ਵਧੀਆ ਜੀ ਵਧੀਆ ਵਧੀਆ ਮੈਂ ਨਾ ਉਹ ਸਿੰਗਲ ਸਟਾਰ ਵੀ ਦੇਖ ਕੇ ਆਈ ਸੀ ਮਿਲੇਨੀਅਮ ਵੀ ਦੇਖਿਆ ਸੀ ਮਿਲੇਨੀਅਮ ਦੇ ਵਿੱਚ ਨਾ ਮੈਨੂੰ ਥੋੜ੍ਹਾ ਠੀਕ ਜਿਹਾ ਲੱਗਿਆ ਸਿੰਗਲ ਸਟਾਰ ਜ਼ਿਆਦਾ ਵਧੀਆ ਲੱਗਿਆ ਸਿੰਗਲ ਸਟਾਰ ਦੇ ਵਿੱਚ ਮੇਰੀ ਫਰੈਂਡ ਦਾ ਬੇਟਾ ਲੱਗਿਆ ਹੋਇਆ ਹਾਂ ਉੱਥੇ ਕਾਫੀ ਕੇਅਰ ਬਹੁਤ ਆ ਬੱਚਿਆਂ ਦੀ ਬਹੁਤ ਜ਼ਿਆਦਾ ਨੇਗੀਆਂ ਬੱਚੇ ਦੀ ਪਰਸਨਲੀ ਕੇਅਰ ਕਰਦੇ ਆ ਉਹ ਹਾਂ ਮਤਲਬ ਕਿ ਉਹਨਾਂ ਦਾ ਜਿਹੜਾ ਫਾਇਦਾ ਫਿਜ਼ੀਕਲ ਵਾਲਾ ਸਟਾਫ ਹੈ ਉਹ ਵੀ ਬਹੁਤ ਜ਼ਿਆਦਾ ਵਧੀਆ ਹੈਗਾ ਹਾਂ ਪਾਣੀ ਵਗੈਰਾ ਸਾਰਾ ਕੁਛ ਬਹੁਤ ਜ਼ਿਆਦਾ ਵਧੀਆ ਬੱਸਾਂ ਦੇ ਵਿੱਚ ਲੇਡੀ ਰੱਖੀ ਹੋਈ ਆ ਉਹਨਾਂ ਨੇ ਹਾਂ ਕੈਮਰੇ ਨੇ ਏਸੀ ਏਸੀ ਵਗੈਰਾ ਹੈ ਟੋਟਲੀ ਐਕਸਟਰਾ ਗੇਮਜ਼ ਵੀ ਨੇ ਸਾਰੀਆਂ ਹਾਂ ਮਤਲਬ ਕਿ ਨਾ ਉਹ ਸ਼ਨੀਵਾਰ ਵਾਲੇ ਦਿਨ ਉਹ ਕਰਦੇ ਆ ਸ਼ਨੀਵਾਰ ਵਾਲੇ ਦਿਨ ਪੂਰਾ ਦਿਨ ਪਲੇਅ ਦਾ ਰੱਖਦੇ ਆ ਉਹ ਉਹਦੇ ਵਿੱਚ ਜਿਹੜਾ ਬੱਚੇ ਦੇ ਜਿਹੜੇ ਦੇ ਵਿੱਚ ਬੱਚੇ ਦਾ ਇੰਟਰਸਟ ਹੁੰਦਾ ਹੈਗਾ ਉਹੀ ਗੇਮ ਉਹਨੂੰ ਦਿੰਦੇ ਹੈਗੇ ਉਹਦੇ 'ਤੇ ਫੋਕਸ ਕਰਦੇ ਆ ਵੈਸੇ ਤਾਂ ਮੈਂ ਇਹ ਵੀ ਸੁਣਿਆ ਸੀ ਇੱਕ ਆਪਣੇ ਇੱਧਰ ਚੀਮਿਆਂ ਦਾ ਪੀਪੀ ਸਕੂਲ ਆ ਉਹ ਵੀ ਬਹੁਤ ਵਧੀਆ ਹੈਗਾ ਹਾਂ ਉਹ ਵੀ ਕਰਾਉਂਦੇ ਹੈ ਮਤਲਬ ਕਿ ਟ ਓਵਰਟਾਈਮ ਲਗਾਉਂਦੇ ਆ ਬੱਚੇ ਦੇ ਪੀਪੀ ਹੋ ਗਿਆ ਮਿਲੇਨੀਅਮ ਹੋ ਗਿਆ ਸਿੰਗਲ ਸਟਾਰ ਹੋ ਗਿਆ ਦੇਖ ਸੁਮਨ ਜੇ ਤਾਂ ਆਪਾਂ ਨੇ ਨੇੜੇ ਦੇਖਣਾ ਹੈ ਫਿਰ ਤਾਂ ਆਪਾਂ ਨੂੰ ਪੀਪੀ ਹੈ ਹੈ ਨਾ ਜੇ ਆਪਾਂ ਮਤਲਬ ਕਿ ਸਾਰਾ ਕੁਛ ਹੀ ਦੇਖਣਾ ਹੈ ਵੀ ਬੱਚੇ ਦੀ ਆਪਣੇ ਬੱਚੇ ਤੋਂ ਉਹਨਾਂ ਦੇ ਛੋਟੇ ਨੇ ਤਾਂ ਆਪਾਂ ਸਿੰਗਲ ਸਟਾਰ ਦੇ ਵਿੱਚ ਲਾ ਦਈਏ ਉੱਥੇ ਕੇਅਰ ਬਹੁਤ ਹੈਗੀ ਹੈ ਤਾਂ ਮਿਲੇਨੀਅਮ ਸਕੂਲ ਹੈ ਜਿਹੜਾ ਮਿਲੇਨੀਅਮ ਹੋ ਗਿਆ ਜ਼ੇਵੀਅਰ ਹੋ ਗਿਆ ਨਾ ਇਹ ਤਾਂ ਸੇਮ ਹੀ ਨੇ ਮਿਲੇਨੀਅਮ ਅਤੇ ਜ਼ੇਵੀਅਰ ਵੀ ਸੇਮ ਹੀ ਮਤਲਬ ਕਿ ਸਾਰਾ ਕੁਛ ਸੇਮ ਹੀ ਆ ਇਹਨਾਂ ਦਾ ਸਾਰਿਆਂ ਦੀ ਮੈਂ ਦੇਖੀ ਸੀ ਬਹੁਤ ਵਧੀਆ ਇਹਨਾਂ ਦਾ ਅਤੇ ਜ਼ਿਆਦਾ ਇਹਨਾਂ ਤੋਂ ਟੋਪ 'ਤੇ ਚੱਲ ਰਿਹਾ ਸਿੰਗਲ ਸਟਾਰ ਸਿੰਗਲ ਸਟਾਰ ਦੇ ਵਿੱਚ ਕੇਅਰ ਬਹੁਤ ਆ ਆਪਾਂ ਉੱਥੇ ਦੇਖ ਲੈਂਦੇ ਹਾਂ ਇੱਕ ਵਾਰ ਜਾ ਕੇ ਜਾ ਆਵਾਂਗੇ ਟਰਾਈ ਮਾਰ ਆਵਾਂਗੇ ਇੱਕ ਵਾਰ ਮੇਰਾ ਮਨ ਹੈ ਵੀ ਪੀਪੀ ਦੇ ਵਿੱਚ ਵੀ ਆਪਾਂ ਦੇਖ ਆਈਏ ਪੀਪੀ ਦੇ ਵਿੱਚ ਵੀ ਵਧੀਆ ਹੈਗਾ ਹਾਂ ਹਾਂ ਬਹੁਤ ਹਾਂ ਹਾਂ ਉਹ ਆਪਾਂ ਦੇਖਦੇ ਹਾਂ ਹਾਂ ਹਾਂ ਹਾਂ ਹਾਂ ਠੀਕ ਹੈ ਚਲ ਆਪਾਂ ਬਣਾਉਂਦੇ ਹਾਂ ਪ੍ਰੋਗਰਾਮ ਠੀਕ ਹੈ ਹਾਂ ਠੀਕ ਹੈ ਓਕੇ